ਮੈਂ ਸੁਨੀਲ ਕੁਮਾਰ ਮਿਰਜ਼ਾਪੁਰ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਆਜ਼ਾਦ ਹੋਣ ਤੋਂ ਪਹਿਲਾਂ ਹਿੰਦੂ ਅਤੇ ਮੁਸਲਮਾਨ ਵਿੱਚ ਬਹੁਤ ਹੀ ਜ਼ਿਆਦਾ ਭਿਅੰਕਰ ਯੁੱਧ ਹੋਇਆ ਜਿਸ ਕਾਰਨ ਸਾਡਾ ਉੱਨੀ ਸੌ ਸੰਤਾਲੀ ਪੰਦਰਾਂ ਅਗਸਤ ਉੱਨੀ ਸੌ ਸੰਤਾਲੀ ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਇਸ ਵਿੱਚ ਹਿੰਦੂ ਅਤੇ ਮੁਸਲਮਾਨ ਆਪਸ ਵਿੱਚ ਬਹੁਤ ਜ਼ਿਆਦਾ ਇਹਨਾਂ ਦਾ ਭਿਅੰਕਰ ਯੁੱਧ ਹੋਇਆ ਵੰਡ ਹੋਈ ਹਿੰਦੂ ਨੇ ਵੱਢ ਵੰਡ ਸਮੇਂ ਆਪਸ ਵਿੱਚ ਆਪਸ ਵਿੱਚ ਵੱਢ ਟੁੱਕ ਸ਼ੁਰੂ ਕਰ ਦਿੱਤੀ ਮੁਸਲਮਾਨਾਂ ਨੇ ਮੁਸਲਮਾਨ ਮੁਸਲਮਾਨਾਂ ਨੇ ਵੀ ਆਪਸ ਵਿੱਚ ਵੱਢ ਟੁੱਕ ਸ਼ੁਰੂ ਕਰ ਦਿੱਤੀ ਲੁਕਦੇ ਲੁਕਦੇ ਬਹੁਤ ਜ਼ਿਆਦਾ ਮੁਸ਼ਕਿਲ ਦੇ ਵਿੱਚ ਆਪਣੇ ਸਥਾਨਾਂ 'ਤੇ ਪੁੱਜੇ ਅਤੇ ਜੇ ਹਿੰਦੂ ਧਰਮ ਦੇ ਵੱਧ ਬੰਦੇ ਹੁੰਦੇ ਸੀ ਮੁਸਲਮਾਨਾਂ ਦੇ ਘੱਟ ਹੁੰਦੇ ਸੀ ਇਹ ਹਿੰਦੂ ਵਾਲੇ ਮੁਸਲਮਾਨਾਂ ਨੂੰ ਵੱਢ ਦਿੰਦੇ ਸੀ ਅਤੇ ਜੇ ਮੁਸਲਮਾਨਾਂ ਦੇ ਜ਼ਿਆਦਾ ਹੁੰਦੇ ਸੀ ਹਿੰਦੂਆਂ ਦੇ ਘੱਟ ਹੁੰਦੇ ਸੀ ਤਾਂ ਮੁਸਲਮਾਨ ਹਿੰਦੂਆਂ ਦੇ ਹਮਲਾ ਕਰਕੇ ਉਹਨਾਂ ਨੂੰ ਵੱਢ ਦਿੰਦੇ ਸੀ ਅਤੇ ਇਸ ਕਾਰਨ ਸਮਾਨ ਸੋਨਾ ਪੈਸਾ ਕੱਪੜੇ ਪੁਰਾਤਨ ਲੋਕ ਉਸ ਸਮੇਂ ਦੇ ਯਾਦ ਕਰਕੇ ਆਪਣਾ ਸਾਰਾ ਸਮਾਨ ਪਾਕਿਸਤਾਨ ਵਿੱਚ ਆਪਣੇ ਆਪਣੇ ਛੱਡ ਆਏ ਅਤੇ ਪੁਰਾਣੇ ਸਮੇਂ ਨੂੰ ਯਾਦ ਕਰਦੇ ਉਸ ਸਮੇਂ ਲੋਕ ਹੁਣ ਵੀ ਯਾਦ ਕਰਦੇ ਹਨ ਧੰਨਵਾਦ ਧੰਨਵਾਦ